ਹੈਲੋ ਨਮਸਕਾਰ ਜੀ ਮੈਂ ਨਰੇਸ਼ ਕੁਮਾਰ ਬੋਲ ਰਿਹਾ ਅੱਜ ਮੈਂ ਗਰੀਬੀ ਅਤੇ ਬੇਰੁਜ਼ਗਾਰੀ ਬਾਰੇ ਬੋਲ ਰਿਹਾ ਕਿ ਸਾਡੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਅਤੇ ਗਰੀਬੀ ਬਹੁਤ ਜ਼ਿਆਦਾ ਵੱਧ ਰਹੀ ਹੈ ਇਹਦਾ ਇਹ ਕਾਰਨ ਹੈ ਕਿ ਪੰਜਾਬ ਵਿੱਚ ਨੌਕਰੀਆਂ ਬਹੁਤ ਘੱਟ ਨੇ ਅਤੇ ਲੋਕਾਂ ਦੇ ਖਰਚੇ ਬਹੁਤ ਜ਼ਿਆਦਾ ਨੇ ਆਬਾਦੀ ਵੱਧ ਹੈ ਪੰਜਾਬ ਸਰਕਾਰ ਉਪਰਾਲੇ ਤਾਂ ਬਹੁਤ ਕਰ ਰਹੀ ਹੈ ਨੌਕਰੀਆਂ ਵੀ ਲਿਆ ਰਹੀ ਹੈ ਪਰ ਫੇਰ ਵੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਆ ਕਿ ਜਿੱਥੇ ਮਤਲਬ ਕਿ ਦੋ ਲੱਖ ਨੌਕਰੀ ਨਿਕਲਦੀ ਹੈ ਉੱਥੇ ਤਿੰਨ ਚਾਰ ਲੱਖ ਬੰਦਾ ਨੌਕਰੀ ਵਾਸਤੇ ਅੱਗੇ ਖੜ੍ਹਾ ਹੈਗਾ ਅਤੇ ਬੇਰੁਜ਼ਗਾਰੀ ਵੱਧ ਰਹੀ ਹੈ ਲੋਕ ਫੇਰ ਕਈ ਦਿਹਾੜੀ ਲਗਾ ਰਹੇ ਨੇ ਕਈ ਕੁਛ ਕਰ ਰਹੇ ਨੇ ਕਈ ਸ਼ਰਾਰਤੀ ਤੱਤ ਮੂਹਰੇ ਉਹੋ ਜਿਹੇ ਨੇ ਜੋ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਅਤੇ ਹੋਰਾਂ ਨੂੰ ਵੀ ਨਸ਼ੇ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਕਿ ਪੰਜਾਬ 'ਚ ਨਸ਼ਾ ਵੀ ਬਹੁਤ ਵੱਧ ਰਿਹਾ ਸਰਕਾਰ ਨੂੰ ਅਪੀਲ ਇਹੀ ਹੈ ਕਿ ਸਰਕਾਰ ਵੱਧ ਤੋਂ ਵੱਧ ਨੌਕਰੀਆਂ ਲਿਆਵੇ ਕਿ ਲੋਕਾਂ ਦਾ ਧਿਆਨ ਉੱਧਰ ਨਸ਼ੇ ਵੱਲ ਘੱਟ ਜਾਵੇ ਬੇਰੁਜ਼ਗਾਰੀ ਘਟੇਗੀ ਤਾਂ ਨਸ਼ਾ ਵੀ ਘਟੇਗਾ ਪਬਲਿਕ ਨੂੰ ਨੌਕਰੀਆਂ ਮਿਲਣਗੀਆਂ ਬੇਰੁਜ਼ਗਾਰੀ ਘਟੇਗੀ ਰੁਜ਼ਗਾਰ ਮਿਲੇਗਾ ਲੋਕਾਂ ਨੂੰ ਚੰਗਾ ਖਾਣਾ ਪੀਣਾ ਮਿਲੇਗਾ ਬੱਚਿਆਂ ਦੀ ਐਜੂਕੇਸ਼ਨ ਵੀ ਸਹੀ ਹੋਏਗੀ ਐਦਾਂ ਕਈ ਬੱਚੇ ਦੋ ਦੋ ਬੱਚੇ ਤਿੰਨ ਤਿੰਨ ਬੱਚੇ ਉਹ ਤਿੰਨ ਬੱਚਿਆਂ ਨੂੰ ਨਹੀਂ ਪੜ੍ਹਵਾ ਪੜ੍ਹਾ ਸਕਦੇ ਰੋਟੀ ਖਾਣਾ ਮੁਸ਼ਕਲ ਹੈ ਬੇਰੁਜ਼ਗਾਰ ਦਾ ਇੱਕ ਬੱਚੇ ਨੂੰ ਬੜਾ ਔਖਾ ਪੜ੍ਹਾ ਰਹੇ ਤਿੰਨ ਤਿੰਨ ਬੱਚਿਆਂ ਨੂੰ ਕਿੱਦਾਂ ਪੜ੍ਹਾਉਣਗੇ ਇਸ ਤਰ੍ਹਾਂ ਸਰਕਾਰ ਨੂੰ ਉਪਰਾਲਾ ਔਰ ਵੱਧ ਕੇ ਚੜ੍ਹ ਕੇ ਕਰਨਾ ਚਾਹੀਦਾ ਹੈ ਨੌਕਰੀਆਂ ਲਿਆਉਣੀਆਂ ਚਾਹੀਦੀਆਂ ਹੈ ਵੱਧ ਤੋਂ ਵੱਧ ਕੰਪਨੀਆਂ ਪੰਜਾਬ 'ਚ ਆਉਣੀਆਂ ਚਾਹੀਦੀਆਂ ਹੈ ਜਿਸ ਕਰਕੇ ਕਿ ਨੌਕਰੀਆਂ ਦਾ ਵਾਧਾ ਹੋਵੇ ਬੇਰੁਜ਼ਗਾਰੀ ਘਟੇ ਓਕੇ ਜੀ